ਅਸੀਂ ਆਪਣੇ ਯੋਗਾ ਸ਼ੈਸ਼ਨਾ ਦੌਰਾਨ ਦਿਮਾਗੀ ਸੋਚ ਨੂੰ ਮੈਡੀਟੇਸ਼ਨ ਕਰਕੇ ਪੈਦਾ ਕਰਦੇ ਹਾਂ ਮੈਡੀਟੇਸ਼ਨ ਕਰਨ ਨਾਲ ਲੋਕਾਂ ਦੇ ਦਿਮਾਗੀ ਸੋਚਣ ਦੀ ਸ਼ਕਤੀ ਵਧਦੀ ਹੈ ਲੋਕਾਂ ਦੀ ਕਈ ਸਾਰੀ ਬਿਮਾਰੀਆਂ ਜਿਵੇਂ ਕਿ ਡਿਪਰੈਸ਼ਨ ਟੈਨਸ਼ਨ ਇਹ ਵੀ ਦੂਰ ਹੁੰਦੀਆਂ ਹਨ ਕਈ ਮਸ਼ਹੂਰ ਯੋਗਾ ਮੈਡੀਟੇਸ਼ਨ ਦੇ ਨਾਂ ਹਨ ਜਿਵੇਂ ਧਿਆਨ ਯੋਗਾ ਮਹਾਨਉਪਵ ਧਿਆਨ ਕਿਰਪਾ ਧਿਆਨ ਮੰਤਰਾ ਧਿਆਨ ਅਤੇ ਆਦਿ ਹੋਰ ਵੀ ਬੜੇ ਨਾਂ ਹਨ ਯੋਗਾ ਮੈਡੀਟੇਸ਼ਨ ਕਰਨ ਲਈ ਤਾਂ ਸਵੇਰੇ ਸਵੇਰੇ ਉੱਠ ਕੇ ਤੜਕੇ ਤੜਕੇ ਕਿਸੇ ਪਾਰਕ ਵਿੱਚ ਜਾ ਕੇ ਤਾਜ਼ੀ ਹਵਾ ਵਿੱਚ ਕਰੋ ਤਾਂ ਹੀ ਇਹਦਾ ਫ਼ਾਇਦਾ ਲਿੱਤਾ ਜਾਂਦਾ ਹੈ ਯੋਗਾ ਕਰਨ ਨਾਲ ਲੋਕੀ ਬੜੇ ਹੀ ਤੰਦਰੁਸਤ ਰਹਿੰਦੇ ਹਨ ਲੋਕਾਂ ਦੀ ਸਿਹਤ ਵੀ ਸਹੀ ਰਹਿੰਦੀ ਹਨ ਯੋਗਾ ਮੈਡੀਟੇਸ਼ਨ ਕਰਨ ਨਾਲ ਕਈ ਲੋਕਾਂ ਦੀਆਂ ਤਾਂ ਦਵਾਈਆਂ ਵੀ ਛੁੱਟ ਜਾਂਦੀਆਂ ਹਨ ਜਿਵੇਂ ਕਿ ਸ਼ੂਗਰ ਬੀ ਪੀ ਦੀ ਦਵਾਈਆਂ ਛੁੱਟ ਜਾਂਦੀਆਂ ਹਨ ਲੋਕ ਯੋਗਾ ਕਰਨ ਲਈ ਸਪੈਸ਼ਲ ਵੱਖਰੀਆਂ ਵੱਖਰੀਆਂ ਯੋਗਾ ਸੈਸ਼ਨ ਵੀ ਜੁਆਇਨ ਕਰਦੇ ਹਨ